ਹੈਲੋ ਹਾਂਜੀ ਤੁਸੀਂ ਸਰਵਣ ਸਿੰਘ ਬੋਲਦੇ ਹੋ ਹਾਂਜੀ ਮੈਨੂੰ ਤੁਹਾਡੇ ਮੰਮੀ ਤੋਂ ਪਤਾ ਚੱਲਿਆ ਕਿ ਤੁਸੀਂ ਕਿਤਾਬਾਂ ਪੜ੍ਹਨ ਦੇ ਬਹੁਤ ਸ਼ਕੀਨ ਹੋ ਹਾਂਜੀ ਹਾਂਜੀ ਅਤੇ ਤੁਹਾਨੂੰ ਕਿਹੜੇ ਕਿਹੜੇ ਹਾਂਜੀ ਕਿਹੜੇ ਕਿਹੜੇ ਲੇਖਕ ਪਸੰਦ ਆ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੈਸੇ ਤਾਂ ਮੈਨੂੰ ਵੀ ਬੁੱਲੇ ਸ਼ਾਹ ਅਤੇ ਹਾਂ ਸੁਰਜੀਤ ਪਾਤਰ ਜੀ ਬਹੁਤ ਪਸੰਦ ਆ ਹਾਂਜੀ ਬੁੱਲੇ ਸ਼ਾਹ ਹਾਂਜੀ ਹਾਂਜੀ ਹਾਂਜੀ ਗਿਆਨ ਬਹੁਤ ਮਿਲਦਾ ਹਾਂਜੀ ਗਿਆਨ ਬਹੁਤ ਮਿਲਦਾ ਬਾਕੀ ਇਹਨਾਂ ਨੇ ਸ਼ੇਅਰ ਬਹੁਤ ਪਸੰਦ ਆ ਜਿਵੇਂ ਸ਼ਿਵ ਕੁਮਾਰ ਬ ਬਟਾਲਵੀ ਦੇ ਸੈ ਸੈਡ ਸੌਂਗ ਬਹੁਤ ਹੈ ਹੈਗੇ ਆ ਹਿੱਟ ਹੋਏ ਆ ਅਤੇ ਉਹ ਵੀ ਬਹੁਤ ਪਸੰਦ ਆ ਹਾਂਜੀ ਅਤੇ ਇਹਦੇ ਤੋਂ ਬਹੁਤ ਵੀ ਗਿਆਨ ਵੀ ਬਹੁਤ ਮਿਲਦਾ ਹਾਂਜੀ ਹੋਰ ਜਿੱਦਾਂ ਆਪਾਂ ਨੂੰ ਕਹਿ ਦਈਏ ਵੀ ਉਹਦੇ ਵਿੱਚੋਂ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚੋਂ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਵਿੱਚੋਂ ਸ਼ਾਇਰੀ ਵਿੱਚੋਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ

ਹਾਂਜੀ ਹਾਂਜੀ ਇਹ ਤਾਂ ਹੈ ਉਹਦੇ ਵਿੱਚੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਚਲੋ ਕੋਈ ਨਹੀਂ ਕਦੇ ਆਪਾਂ ਕਦੇ ਇਕੱਠੇ ਹੋਵਾਂਗੇ ਉਦੋਂ ਫਿਰ ਬੈਠ ਕੇ ਡਿਸਕਸ ਕਰਾਂਗੇ ਇਹਨਾਂ ਬਾਰੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ